ਹੈਲੋ ਸਰ ਓਏਲਾ ਕੰਪਨੀ ਤੋਂ ਬੋਲਦੇ ਜੋ ਤੁਹਾਡੇ ਕੋਲ ਵੱਡੀਆਂ ਗੱਡੀਆਂ ਵੀ ਆ ਅਤੇ ਛੋਟੀਆਂ ਗੱਡੀਆਂ ਵੀ ਆ ਤੇ ਅਸੀਂ ਨਾ ਇੱਕ ਵੱਡੀ ਗੱਡੀ ਚਾਹੀਦੀ ਸੀ ਸਾਨੂੰ ਜਿਹਦੇ ਵਿੱਚ ਅਸੀਂ ਛੇ ਜੀਅ ਬੈਠ ਸਕੀਏ ਅਤੇ ਇੱਕ ਛੋਟੀ ਚਾਹੀਦੀ ਸੀ ਜਿਹਦੇ ਵਿੱਚ ਜਣੇ ਵਧੀਆ ਬੈਠ ਸਕਣ ਤਾਂ ਛੋਟੀ ਗੱਡੀ ਦਾ ਕੀ ਕਰਾਇਆ ਹੈ ਅਤੇ ਵੱਡੀ ਦਾ ਕੀ ਆ ਕਿੰਨੇ ਪੈਸੇ ਆ ਅਸੀਂ ਦੂਰ ਨਹੀਂ ਜਾਣਾ ਹੈਗਾ ਅਸੀਂ ਅੰਮ੍ਰਿਤਸਰ ਤੱਕ ਜਾਣਾ ਹੈਗਾ ਹੈ ਦੁਰਗਿਆਣਾ ਮੰਦਿਰ ਜਾਣਾ ਹੈ ਦਰਬਾਰ ਸਾਹਿਬ ਜਾਣਾ ਹੈ ਗੁਰੂ ਕਾ ਬਾਗ ਜਾਣਾ ਹੈ ਜ਼ਿਲ੍ਹਿਆ ਵਾਲੇ ਬਾਗ ਦੇਖਣ ਜਾਣਾ ਹੈ ਤਾਂ ਤੁਸੀਂ ਟਾਈਮ ਸਿਰ ਜਿੱਦਾਂ ਟਾਈਮ ਨਾਲ ਅਸੀਂ ਜਾਣਾ ਏ ਟਾਈਮ ਸਿਰ ਤੁਹਾਡੇ ਡਰਾਈਵਰ ਸਾਡੇ ਕੋਲ ਗੱਡੀ ਲੈ ਕੇ ਆ ਜਾਣ ਤਾਂ ਅਸੀਂ ਟਾਈਮ ਨਾਲ ਜਾ ਸਕੀਏ ਅਤੇ ਟਾਈਮ ਨਾਲ ਦਰਸ਼ਨ ਕਰਕੇ ਦਰਬਾਰ ਸਾਹਿਬ ਤੋਂ ਘੁੰਮ ਕੇ ਹੋਰ ਜਗ੍ਹਾ ਤੋਂ ਅਤੇ ਟਾਈਮ ਨਾਲ ਘਰ ਆ ਜਾਈਏ ਮੈਂ ਤੁਹਾਡੀ ਮਿਹਰਬਾਨੀ ਕਰਦੀ ਹਾਂ ਅਤੇ ਬਾਕੀ ਛੋਟੀ ਗੱਡੀ ਦੇ ਕਿੰਨੇ ਪੈਸੇ ਅਤੇ ਵੱਡੀ ਦੇ ਕਿੰਨੇ ਪੈਸੇ ਆ ਇਹਦੇ ਵਿੱਚ ਅਸੀਂ ਛੇ ਜੀਅ ਚਾਰ ਜੀਅ ਵਧੀਆ ਬੈਠ ਜਾਈਏ ਆਰਾਮਦਾਇਕ ਸਫ਼ਰ ਹੋਵੇ ਸਾਡਾ ਓਕੇ